ਅਤੇ ਜੇ ਅਸੀਂ ਅੱਜ ਗੱਲਾਂ ਕਰੀਏ ਨਾ ਆਪਣੇ ਜੜ੍ਹਾਂ ਨਾਲ਼ ਜੁੜਣ ਦੀਆਂ ਤਾਂ ਉਸਦਾ ਸਭ ਤੋਂ ਵੱਡੀ ਮਿਸਾਲ ਅਸੀਂ ਕਹਿ ਸਕਦੇ ਹਾਂ ਸਾਡੇ ਦਾਦਾ ਦਾਦੀ ਜੀ ਜੋ ਸੀ ਹੈ ਨਾ ਉਹ ਸਾਨੂੰ ਗੱਲਾਂ ਸਮਝਾਉਂਦੇ ਸਨ ਅਤੇ ਕਲਚਰ ਬਾਰੇ ਸੱਭਿਆਚਾਰ ਬਾਰੇ ਸਮਝਾਉਣਾ ਕਿ ਵਿਆਹ ਕਿਵੇਂ ਹੁੰਦੇ ਸੀ ਲੋਕ ਆਪਸ 'ਚ ਕਿਵੇਂ ਰਹਿੰਦੇ ਸੀ ਲੋਕਾਂ ਦਾ ਪਿਆਰ ਕਿਵੇਂ ਸੀ ਅਤੇ ਆਜ਼ਾਦੀ ਵੇਲੇ ਕੀ ਕੀ ਦੇਖਿਆ ਉਹਨਾਂ ਨੇ ਕੀ ਕੀ ਸਹਿਆ ਉਸ ਬਾਰੇ ਦੱਸਦੇ ਸੀ ਅਤੇ ਸਾਡੇ ਪੰਜਾਬ 'ਤੇ ਜੋ ਕਾਲਾ ਦੌਰ ਰਿਹਾ ਚੁਰਾਸੀ ਦਾ ਉਸ ਬਾਰੇ ਵੀ ਦੱਸਦੇ ਰਹੇ ਸਾਨੂੰ ਦੱਸਦੇ ਸੀ ਅਤੇ ਉਹਨਾਂ ਨੇ ਸਾਨੂੰ ਹਮੇਸ਼ਾਂ ਜ਼ਿੰਦਗੀ 'ਚ ਚੰਗੇ ਕੰਮਾਂ ਲਈ ਸਮਝਾਉਣਾ ਕੀਤਾ ਅਤੇ ਸਾਡੇ ਜੋ ਵੀ ਸਾਡੀਆਂ ਪੁਰਾਣੀਆਂ ਪੀੜ੍ਹੀਆਂ ਉਹਨਾਂ ਨਾਲ਼ ਜੁੜਦੇ ਰਹਿਣ ਨੂੰ ਸਾਨੂੰ ਪ੍ਰੇਰਿਤ ਕਰਦੇ ਰਹੇ ਅਤੇ ਸਾਨੂੰ ਹਮੇਸ਼ਾਂ ਆਪਣੀਆਂ ਪੁਰਾਣੀਆਂ ਗੱਲਾਂ ਯਾਦਾਂ ਹੈ ਨਾ ਆਪਣੇ ਵਿਆਹ ਦੀਆਂ ਗੱਲਾਂ ਅਤੇ ਪਿੰਡ 'ਚ ਹੋਰਾਂ ਦੇ ਵਿਆਹ ਦੀਆਂ ਗੱਲਾਂ ਜਾਂ ਲੋਕਾਂ ਦੇ ਆਪਸੀ ਭਾਈਚਾਰੇ ਅਤੇ ਪਿਆਰ ਦੀਆਂ ਗੱਲਾਂ ਸਾਨੂੰ ਸਮਝਾਉਂਦੇ ਰਹਿੰਦੇ ਸੀਗੇ ਅਤੇ ਸਾਨੂੰ ਸਾਡੀਆਂ ਜੜ੍ਹਾਂ ਨਾਲ਼ ਜੋੜਦੇ ਜੁੜ ਕੇ ਰਹਿਣ ਦੀ ਗੱਲ ਕਹਿ ਕਹਿੰਦੇ ਰਹਿੰਦੇ ਸਨ